ਕੁਝ ਦਿਨ ਪਹਿਲਾਂ ਮੈਂ ਔਨਲਾਈਨ ਸ਼ੋਪਿੰਗ ਤੋਂ ਈਕੁਮਰਸ ਵੈਬਸਾਈਟਸ ਤੋਂ ਚਾਰ ਬੈੱਡ ਸ਼ੀਟਾਂ ਮੰਗਵਾਈਆਂ ਸੀਗੀਆਂ ਅਤੇ ਜਦੋਂ ਉਹ ਆਈਆਂ ਉਹਨਾਂ ਵਿੱਚੋਂ ਮੈਨੂੰ ਚਾਰ ਬਹੁਤ ਵੱਡੀਆਂ ਕਮੀਆਂ ਦਿਖੀਆਂ ਮੈਂ ਤੁਹਾਡੇ ਨਾਲ ਆਪਣੀ ਸਾਰੀ ਜਿਹੜੀ ਟੈਨਸ਼ਨ ਹੈਗੀ ਉਹਨਾਂ ਨੂੰ ਲੈ ਕੇ ਉਹ ਸ਼ੇਅਰ ਕਰਨਾ ਚਾਹੁੰਦਾ ਅਤੇ ਸਭ ਤੋਂ ਪਹਿਲਾਂ ਜਿਹੜੀ ਬੈੱਡ ਸ਼ੀਟਾਂ ਮੈਂ ਮੰਗਾਈਆ ਸੀਗੀਆਂ ਉਹਨਾਂ ਦੇ ਉਹਨਾਂ ਦਾ ਸਾਈਜ਼ ਹੋਣਾ ਚਾਹੀਦਾ ਸੀ ਕਿੰਗ ਸਾਈਜ਼ ਬੈੱਡ ਲਈ

ਚਾਰ ਬੈੱਡ ਸ਼ੀਟਾਂ ਵਿੱਚੋਂ ਦੋ ਬੈੱਡ ਸ਼ੀਟਾਂ ਸਿੰਗਲ ਸਾਈਜ਼ ਬੈੱਡ ਸੀ ਦੀ ਸੀਗੀਆਂ ਸਭ ਤੋਂ ਵੱਡੀ ਗਲਤੀ ਹੈ ਕਿ ਕੋਈ ਬੈੱਡ ਸ਼ੀਟਾਂ ਮੰਗਾਏਗਾ ਕਿੰਗ ਸਾਈਜ਼ ਬੈੱਡ ਲਈ ਅਤੇ ਸਿੰਗਲ ਸਾਈਜ ਬੈੱਡ ਲਈ ਆਉਣਗੀਆਂ ਤਾਂ ਕਿੱਦਾਂ ਚਲੇਗਾ ਪਹਿਲੀ ਗਲਤੀ ਦੂਜੀ ਗਲਤੀ ਉਹਨਾਂ ਵਿੱਚੋਂ ਇੱਕ ਵੱਡੀ ਬੈਡਸ਼ੀਟ ਵਿੱਚ ਬਹੁਤ ਸਾਰੇ ਛੇਦ ਸੀਗੇ ਜਿਨ੍ਹਾਂ ਕਰਕੇ ਉਹਦਾ ਪੂਰਾ ਕਾ ਪੂਰਾ ਦਾ ਪੂਰਾ ਲੁਕ ਜਿਹਾ ਖ਼ਰਾਬ ਹੋ ਗਿਆ ਦੂਜੀ ਗਲਤੀ ਤੀਜੀ ਗਲਤੀ ਜਦੋਂ ਮੈਂ ਬੈੱਡ ਸ਼ੀਟਾਂ ਮੰਗਾ ਰਿਹਾ ਸੀ ਟੀ ਵੀ ਵਿੱਚ ਦੱਸ ਰਹੇ ਸੀਗੇ ਕਿ ਉਹਨਾਂ ਉੱਤੇ ਡੋਲਫਿਨ ਵਗੈਰਾ ਬਣੀ ਹੋਏਗੀ ਪਰ ਜਦੋਂ ਉਹ ਆਈਆਂ ਨੇ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਉਹਨਾਂ ਉੱਤੇ ਕੁਛ ਵੀ ਨਹੀਂ ਬਣੇਗਾ ਮਤਲਬ ਕੁਝ ਫੁੱਲ ਪੱਤੇ ਬਣੇਦੇ ਨੇ ਬਸ ਤੀਜੀ ਗਲਤੀ ਹੁਣ ਚੌਥੀ ਗਲਤੀ ਸਾਰੀਆਂ ਗਲਤੀਆਂ ਨੂੰ ਅਣਦੇਖਾ ਕਰ ਤਾ ਪਰ ਜਦੋਂ ਉਹਨਾਂ ਨੂੰ ਧੋਇਆ ਉਹਨਾਂ ਨੇ ਰੰਗ ਛੱਡਣਾ ਸ਼ੁਰੂ ਕਰ ਤਾ